ਖਾਣਾ ਬਣਾਉਣ ਦਾ ਮੈਨੂੰ ਬਹੁਤ ਸ਼ੌਂਕ ਹੈ ਖਾਣਾ ਪਕਾਉਣਾ ਖਾਣਾ ਸਰਵ ਕਰਨਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਖਾਣਾ ਪਕਾਉਣ ਵੇਲੇ ਮੈਂ ਕਈ ਤਰ੍ਹਾਂ ਦੇ ਬਰਤਨ ਅਤੇ ਕਟਲਰੀ ਵਰਤਦੀ ਹਾਂ ਜਿਵੇਂ ਕਿ ਅਲਮੀਨੀਅਮ ਦੀ ਸਟੀਲ ਦੀ ਜਾਂ ਫਿਰ ਆ ਨੋਨ ਸਟਿਕੀ ਇਹ ਵਰਤਦੀ ਹਾਂ ਕਿਉਂਕਿ ਜਿਹੜੇ ਤਾਂ ਅਲਮੀਨੀਅਮ ਦੇ ਭਾਂਡੇ ਨੇ ਉਹਨਾਂ 'ਚ ਮੈਂ ਜ਼ਿਆਦਾਤਰ ਗਰੇਵੀ ਵਾਲੀਆਂ ਚੀਜ਼ਾਂ ਬਣਾਉਂਦੀ ਹਾਂ ਉਹ ਮੈਨੂੰ ਵਧੀਆ ਲੱਗਦੀਆਂ ਉਹਦੇ 'ਚ ਬਣਾਉਣੀਆਂ ਅਲਮੀਨੀਅਮ ਵਾਲੇ ਭਾਂਡਿਆਂ 'ਚ ਅਤੇ ਐਲਮੀਨੀਅਮ ਵਾਲੀ ਕਟਲਰੀ ਮੈਨੂੰ ਵਰਤਣੀ ਵਧੀਆ ਲੱਗਦੀ ਹੈ ਅਤੇ ਜਦੋਂ ਮੈਂ ਕੋਈ ਪਰਾਂਠੇ ਬਣਾਉਣੇ ਹੁੰਦੇ ਨੇ ਜਾਂ ਫਿਰ ਡੋਸਾ ਬਣਾਉਣਾ ਹੁੰਦਾ ਏ ਕੋਈ ਬੇਸਨ ਦਾ ਚੀਲਾ ਬਣਾਉਣਾ ਹੁੰਦਾ ਏ ਤਾਂ ਫਿਰ ਉਹ ਮੈਨੂੰ ਨੋਨ ਸਟਿਕੀ ਵਧੀਆ ਲੱਗਦਾ ਕਿਉਂਕਿ ਨੋਨ ਸਟਿਕੀ ਦੇ ਨੋਨ ਸਟਿਕੀ ਦੀ ਇਹ ਗੱਲ ਹੈ ਕਿ ਉਹਦੇ 'ਤੇ ਚਿਪਕਦਾ ਨਹੀਂ ਹੈਗਾ ਖਾਣਾ ਜਦੋਂ ਤੁਸੀਂ ਕੋਈ ਪਰਾਂਠਾ ਬਣਾਉਂਦੇ ਹੋ ਕੋਈ ਤੁਸੀਂ ਚੀਲਾ ਬਣਾਉਂਦੇ ਹੋ ਕੋਈ ਤੁਸੀਂ ਡੋਸਾ ਬਣਾਉਂਦੇ ਹੋ ਤਾਂ ਉਹਦੇ ਤੇ ਉਹ ਲੱਗੇਗਾ ਨਹੀਂ ਉਹ ਜਿਵੇਂ ਤੁਸੀਂ ਬਣਾਓਗੇ ਉਵੇਂ ਵਧੀਆ ਤਰੀਕੇ ਨਾਲ ਬਣ ਜਾਵੇਗਾ ਉਹਦੇ 'ਤੇ ਚਿਪਕਣਾ ਨਹੀਂ ਹੈਗਾ ਅਤੇ ਜਿਹੜੇ ਸਟੀਲ ਦੇ ਬਰਤਨ ਹੈ ਉਹ ਮੈਨੂੰ ਖ਼ਾਣਾ ਜਿਵੇਂ ਕਿ ਚਾਹ ਬਣਾਉਣੀ ਦੁੱਧ ਗਰਮ ਕਰਨਾ ਜਾਂ ਫਿਰ ਕੋਈ ਹੋਰ ਸਵੀਟ ਡਿਸ਼ ਬਣਾਉਣੀ ਉਹ ਮੈਨੂੰ ਸਟੀਲ ਦੇ ਭਾਂਡਿਆਂ 'ਚ ਬਣਾਉਣੀ ਵਧੀਆ ਲੱਗਦੀ ਹੈ ਕਿਉਂਕਿ ਜਿਹੜਾ ਦੁੱਧ ਵਾਲੇ ਦੁੱਧ ਵਾਲੀਆਂ ਮੈਂ ਪਕਵਾਨ ਬਣਾਉਂਦੀ ਹਾਂ ਮੈਂ ਹਮੇਸ਼ਾ ਸਟੀਲ ਦੇ ਭਾਂਡਿਆਂ 'ਚ ਹੀ ਬਣਾਉਂਦੀ ਹਾਂ ਮੈਨੂੰ ਉਹਨਾਂ 'ਚ ਬਣਾਉਣੀ ਉਹ ਬਹੁਤ ਵਧੀਆ ਲੱਗਦੀ ਹੈ ਅਤੇ ਮੈਨੂੰ ਸਟੀਲ ਦੀ ਕਟਲਰੀ ਜ਼ਿਆਦਾ ਪਸੰਦ ਹੈ ਉਹ ਮੈਂ ਜ਼ਿਆਦਾਤਰ ਆਪਣੇ ਜਦੋਂ ਡਾਇਨਿੰਗ ਟੇਬਲ 'ਤੇ ਮੈਂ ਸਟੀਲ ਦੀ ਕਟਲਰੀ ਹੀ ਰੱਖੀ ਹੋਈ ਹੈ ਮੈਨੂੰ ਬਹੁਤ ਵਧੀਆ ਲੱਗਦੀ ਹੈ ਸਟੀਲ ਦੀ ਕਟਲਰੀ